ਮੈਂ ਫਸਟ ਟਾਈਮ ਕਰੋਕਰੀ ਦਾ ਔਡਰ ਕੀਤਾ ਔਨਲਾਈਨ ਔਰ ਉਹਨਾਂ ਨੇ ਜਿਹੜੀ ਡਿਲੀਵਰੀ ਦੇਣ ਤੋਂ ਪਹਿਲਾਂ ਮੇਰੇ ਤੋਂ ਪੇਮੈਂਟ ਮੰਗੀ ਅਤੇ ਮੈਂ ਪੇਮੈਂਟ ਉਸੇ ਵੇਲੇ ਉਹਨਾਂ ਦੇ ਅਕਾਊਂਟ 'ਚ ਡਾਲ ਦਿੱਤੀ ਜਦੋਂ ਮ ਸਮਾਨ ਆਇਆ ਜੋ ਮੈਂ ਔਡਰ ਕੀਤਾ ਸੀ ਉਹਦੇ ਮੁਤਾਬਕ ਨਹੀਂ ਸੀ ਔਰ ਉਹਦਾ ਕਲਰ ਸਕੀਮ ਵੀ ਜੋ ਮੈਂ ਉਹਨਾਂ ਨੂੰ ਕਹੀ ਸੀ ਉਹ ਨਹੀਂ ਸੀ ਮੈਂ ਇਹਨਾਂ ਨੂੰ ਕਿਹਾ ਕਿ ਇਹ ਪ੍ਰੋਡਕਟ ਨੂੰ ਬਦਲ ਕੇ ਦਿਉ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਔਰ ਇਸ ਕਰਕੇ ਮੇਰਾ ਇਹ ਫਾਈਨੈਂਸ਼ੀਅਲ ਲੋਸ ਹੋਇਆ ਔਰ ਇਹ ਕੰਪਨੀ ਨੂੰ ਇਸ ਚੀਜ਼ ਦਾ ਹਰਜਾਨਾ ਦੇਣਾ ਚਾਹੀਦਾ ਜਿਹੜਾ ਕਿ ਉਹ ਦੇਣ ਤੋਂ ਇਨਕਾਰ ਕਰ ਰਹੇ ਹਨ ਜਿਹੜਾ ਕਿ ਮੈਂ ਔਨਲਾਈਨ ਸ਼ੋਪਿੰਗ ਕਰਨ ਤੋਂ ਡਿਸਕਰੇਜ ਹੋ ਰਿਹਾ ਹਾਂ ਅੱਗੇ ਤੋਂ ਮੈਂ ਕੋਈ ਵੀ ਸ਼ੋਪਿੰਗ ਔਨਲਾਈਨ ਕਰਨਾ ਨਹੀਂ ਚਾਹਵਾਂਗਾ